ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੋਹਾਲੀ ਤੋਂ ਫੂੜ ਵਲੋਗਰ ਜੀ ਉਹ ਕੀ ਹੁੰਦਾ ਅੱਛਾ ਜੀ ਅੱਛਿਆ ਠੀਕ ਹੈ ਜੀ ਹਾਂਜੀ ਹਾਂਜੀ ਸਾਡੇ ਮੋਹਾਲੀ 'ਚ ਹੈਗੀਆਂ ਨੇ ਬਹੁਤ ਜਿਵੇਂ ਕਿ ਗੁਰੂ ਨਾਨਕ ਵਾਲਿਆਂ ਦੀ ਹੋ ਗਈ ਸਵੀਟਸ ਸ਼ਾਪ ਗੋਪਾਲਸ ਵਾਲਿਆਂ ਦੀ ਹੋ ਗਈ ਇਹ ਸਾਰੀਆਂ ਦੇਖੋ ਜੀ ਜੇ ਗੱਲ ਕਰੀਏ ਗੁਰੂ ਨਾਨਕ ਵਾਲਿਆਂ ਦੀ ਉਨ੍ਹਾਂ ਦਾ ਜਿਹੜੇ ਲੱਡੂ ਐਗੇ ਉਹਦੇ ਦੇਸੀ ਘਿਉ 'ਚ ਬਣਦੇ ਹੈ ਮੋਤੀ ਚੂਰ ਦੇ ਲੱਡੂ ਜਿਹੜੇ ਕਿ ਬਿਨ੍ਹਾਂ ਕਿਸੇ ਮਿਲਾਵਟ ਤੋਂ ਜਾਂ ਜਿੰਨ੍ਹੇ ਵੀ ਮਿਠਾਈਆਂ ਬਣਾਉਂਦੇ ਨੇ ਉਹ ਤੁਹਾਨੂੰ ਪਤਾ ਈ ਹੈ ਅੱਜਕੱਲ੍ਹ ਕਿੰਨੀ ਮਿਲਾਵਟ ਚੱਲ ਰਹੀ ਹੈ ਉਹ ਬਿਨਾਂ ਪਿਓਰ ਹੁੰਦੇ ਐਂਨ ਬਿਲਕੁਲ ਸਾਫ਼ ਸੁਥਰੇ ਐਂ ਨਹੀਂ ਕੋਈ ਗੰਦੀ ਮੰਦੀ ਜਗ੍ਹਾਂ ਰੱਖੇ ਹੋਏ ਬਿਲਕੁਲ ਸਾਫ਼ ਤਰੀਕੇ ਨਾਲ਼ ਬਣਾਉਂਦੇ ਹੈ ਉਹ ਅਤੇ ਗੋਪਾਲਸ ਵਾਲਿਆਂ ਦੀ ਹੁੰਦੀ ਜਲੇਬੀ ਸ਼ਾਮ ਨੂੰ ਜਿੱਥੇ ਕਿ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਉਹਨੂੰ ਖਾਣ ਵਾਸਤੇ ਅੱਛਾ ਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਅਸੀਂ ਜ਼ਰੂਰ ਤੁਹਾਨੂੰ ਫੋਲੋ ਕਰਾਂਗੇ ਅਤੇ ਤੁਸੀਂ ਆਉ ਤਾਂ ਆਪਣੇ ਨਾਲ ਹੋਰਾਂ ਨੂੰ ਵੀ ਲੈ ਕੇ ਆਉ ਹਾਂਜੀ ਹਾਂਜੀ ਕੋਈ ਨਾ ਜੀ ਕੋਈ ਨਾ ਧੰਨਵਾਦ ਓਕੇ ਜੀ ਕੇ